ਪਿਛਲੇ ਦਹਾਕੇ ਤੋਂ ਪਟਰੋਲ ਦੀਆਂ ਕੀਮਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ ਲਗਭਗ ਲਗਭਗ ਪਿਛਲੇ ਤਿੰਨ ਚਾਰ ਸਾਲਾਂ ਵਿੱਚ ਵੀਹ ਰੁਪਏ ਦੇ ਕਰੀਬ ਪਟਰੋਲ ਦੀਆਂ ਕੀਮਤਾਂ ਵੱਧ ਚੁੱਕੀਆਂ ਹਨ ਇਸ ਦੇ ਨਾਲ ਬਾਈਕਿੰਗ ਅਤੇ ਕਾਰ ਦੇ ਨਾਲ ਕਿਤੇ ਵੀ ਜਾਣਾ ਬੜਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਜਿਸ ਵਿੱਚ ਲਗਾਤਾਰ ਇਸ ਪਾਸੇ ਵੱਲ ਹਰੇਕ ਦਾ ਖਰਚਾ ਜੋ ਹੈ ਉਹ ਵੱਧ ਰਿਹਾ ਹੈ ਪਰੰਤੂ ਇੱਕ ਗੱਲ ਇਹ ਵੀ ਹੈ ਕਿ ਜੇਕਰ ਲਗਾਤਾਰ ਅਸੀਂ ਵਾਹਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਹਾਂ ਜੇਕਰ ਕੇਵਲ ਇੱਕ ਜਣਾ ਹੀ ਕਾਰ ਲੈ ਕੇ ਆਪਣੇ ਕੰਮ 'ਤੇ ਜਾਂਦਾ ਹੈ ਤਾਂ ਉਸ ਨਾਲ ਬਾਲਣ ਦੀ ਵਰਤੋਂ ਜ਼ਿਆਦਾ ਹੋਣ ਕਾਰਨ ਵਾਤਾਵਰਨ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਕੱਠਿਆਂ ਵੱਧ ਤੋਂ ਵੱਧ ਕੰਮ 'ਤੇ ਜਾਇਆ ਜਾਵੇ ਜਿਸ ਨਾਲ ਗੱਡੀ ਦੇ ਵਿੱਚ ਚਾਰ ਜਾਂ ਪੰਜ ਜਣੇ ਹੀ ਸਵਾਰੀ ਕਰਨ ਨਾ ਕਿ ਇਕੱਲਾ ਇਕੱਲਾ ਗੱਡੀ ਦੀ ਸਵਾਰੀ ਕਰੇ